ਮੈਨੂੰ ਜਿਹੜੇ ਆਪਣਾ ਗੀਤ ਪਸੰਦ ਨੇ ਮੈਨੂੰ ਉਹ ਆਪਣਾ ਗੀਤ ਪਸੰਦ ਨੇ ਜਾਂ ਜਿਹੜੇ ਆਪਣਾ ਆਪਣਾ ਗੀਤ ਸਮਾਜ ਨੂੰ ਸੇਧ ਮਕ ਕਿ ਆਪਣਾ ਸਮਾਜ ਨੂੰ ਸੇਧ ਮਕ ਕਿ ਆਪਣਾ ਦਿੰਦੇ ਹਨ ਜੋ ਕੀ ਸੱਭਿਆਚਾਰ ਨਾਲ ਮ ਆਪਣਾ ਜੋੜਦੇ ਹਨ ਅਤੇ ਜਿਹੜੇ ਆਪਣਾ ਆਪਣਾ ਗੀਤਾਂ ਦੇ

ਅਤੇ ਜੋ ਆਪਣਾ ਗੀਤ ਹਨ ਗੀ ਆਪਣਾ ਗੀਤਾਂ ਦੇ ਹੀ ਜਰ ਜਰੀਏ ਜੋ ਅੱਛਾ ਇਨਸਾਨ ਦੇ ਪੱਖ ਨੇ ਗੱਲਾਂ ਨੇ ਉਹ ਸਮਾਜ ਅੰਦਰ ਰੱਖੀਆਂ ਆਪਣੇ ਵਿੱਚ ਆਉਂਦੀਆਂ ਹਨ ਜੋ ਗੀਤ ਇੱਦਾਂ ਦੇ ਹੋਣ ਜੋ ਆਪਣੇ ਘਰਾਂ ਦੇ ਅੰਦਰ ਆਪਣੀਆਂ ਮਾਂ ਦੇ ਅੰਦਰ ਆਪਣੀ ਭੈਣ ਦੇ ਅੰਦਰ ਭਰਾਵਾਂ ਦੇ ਅੰਦਰ ਸਮਾਜ ਦੇ ਅੰਦਰ ਪਰਿਵਾਰਿਕ ਆਪਾਂ ਬੈਠ ਕੇ ਸੁਣ ਸਕੀਏ ਆਪਣਾ ਜਿਨ੍ਹਾਂ ਨੂੰ ਆਪਾਂ ਸੁਣਦੇ ਹੋਈਏ ਮਾਣ ਮਹਿਸੂਸ ਆਪਣਾ ਕਰੀਏ ਆਪਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ ਮੈਨੂੰ ਇੱਦਾਂ ਦੇ ਆਪਣਾ ਗੀਤ ਪਸੰਦ ਸਨ ਜੋ ਕਿ ਆਪਣਾ ਗੀਤ ਜੋ ਕਿ ਆਪਣਾ ਗੀਤਾਂ ਦੇ ਨਾਲ ਹੀ ਮੇਰਾ ਅੱਛ ਮਨ ਲੱਗਿਆ ਹੋਇਆ ਹੈ